ਸਤਿ ਸ਼੍ਰੀ ਅਕਾਲ ਜੀ ਤੁਸੀਂ ਪੁੱਛਿਆ ਏ ਪੁਰਾਣੇ ਗੀਤਾਂ ਅਤੇ ਅੱਜ ਦੇ ਗੀਤਾਂ ਵਿੱਚ ਫਰਕ ਕੀ ਹੈ ਮੈਨੂੰ ਬਹੁਤ ਵਧੀਆ ਲੱਗਦੇ ਪੁਰਾਣੇ ਗੀਤ ਪੁਰਾਣੇ ਗੀਤਾਂ ਵਿੱਚ ਬਹੁਤ ਹੀ ਸਾਦਾਪਨ ਅਤੇ ਵਧੀਆ ਢੰਗ ਸੀ ਅੱਜ ਦੇ ਜ਼ਮਾਨੇ 'ਚ ਜੋ ਵੀ ਤੜਕ ਭੜਕ ਹੈ ਗੀਤਾਂ ਵਿੱਚ ਉਹ ਪਹਿਲਾਂ ਨਹੀਂ ਸੀ ਪਹਿਲਾਂ ਉਹ ਬਹੁਤ ਹੀ ਵਧੀਆ ਢੰਗ ਨਾਲ ਸ਼ਾਂਤ ਸੁਭਾਅ ਦੇ ਨਾਲ ਗੀਤ ਗਾਏ ਜਾਂਦੇ ਸੀ ਅੱਜ ਕੱਲ੍ਹ ਤਾਂ ਬਹੁਤ ਤੜਕ ਭੜਕ ਵਾਲੇ ਗੀਤ ਆ ਗਏ ਨੇ ਜਿਹੜੇ ਲੋਕਾਂ ਨੂੰ ਗਲਤ ਡਾਇਰੈਕਸ਼ਨ ਵੱਲ ਵੀ ਪਾਉਂਦੇ ਨੇ ਕਿ ਅੱਜ ਦੇ ਜ਼ਮਾਨੇ 'ਚ ਗੀਤ ਸਹੀ ਢੰਗ ਨਾਲ ਨਹੀਂ ਆ ਰਹੇ ਪਹਿਲੇ ਜ਼ਮਾਨੇ ਦੇ ਗੀਤ ਬਹੁਤ ਵਧੀਆ ਸੀ ਬਹੁਤ ਹੀ ਵਧੀਆ ਢੰਗ ਨਾਲ ਗਾਏ ਜਾਂਦੇ ਸੀ ਸਾਫ ਸੁਥਰੇ ਢੰਗ ਨਾਲ ਅਤੇ ਵਧੀਆ ਵੀ ਲੱਗਦੇ ਸੀ ਅਤੇ ਸਾਨੂੰ ਪੁਰਾਣੇ ਗੀਤ ਜ਼ਿਆਦਾ ਪਸੰਦ ਏ ਅਤੇ ਉਹੀ ਵਧੀਆ ਲੱਗਦੇ ਨੇ ਕਿਉਂਕਿ ਉਹਨਾਂ ਵਿੱਚ ਇੰਨੀ ਤੜਕ ਭੜਕ ਜਾਂ ਕੋਈ ਵੀ ਪ੍ਰ ਪ੍ਰੋਬਲਮ ਨਹੀਂ ਲੱਗਦੀ ਸੀ ਅਤੇ ਅੱਜ ਦੇ ਜ਼ਮਾਨੇ ਵਿੱਚ ਉਹ ਚੀਜ਼ ਨਹੀਂ ਹੈ ਕਿਉਂਕਿ ਅੱਜ ਦੇ ਜ਼ਮਾਨੇ 'ਚ ਬਹੁਤ ਜ਼ਿਆਦਾ ਤੜਕ ਭੜਕ ਭੜਕਾਵੇ ਗੀਤ ਆ ਗਏ ਨੇ ਜਿਹੜੇ ਬੱਚਿਆਂ ਨੂੰ ਗਲਤ ਰਾਹੇ ਪਾ ਰਹੇ ਨੇ ਗਲਤ ਡਰੈਕਸ਼ਨ ਵੱਲ ਜਾ ਰਹੇ ਨੇ ਅੱਜ ਦੇ ਬੱਚੇ ਅੱਜ ਦੀ ਜਨਰੇਸ਼ਨ ਬਹੁਤ ਹੀ ਗਲਤ ਢੰਗ ਵੱਲ ਹੋ ਗਈ ਏ ਕਿਉਂਕਿ ਪਹਿਲੋਂ ਇਹ ਸਭ ਸਿਸਟਮ ਨਹੀਂ ਸੀ ਸਹੀ ਸਿਸਟਮ ਸੀ ਅਤੇ ਸਹੀ ਸਿਸਟਮ ਨਾਲ ਸਾਰੇ ਚੱਲਦੇ ਸੀ ਅੱਜ ਗੀਤਾਂ ਦੇ ਨਾਲ ਬਹੁਤ ਗਲਤ ਅਸਰ ਪੈ ਰਿਹਾ ਬੱਚਿਆਂ ਨੂੰ ਅੱਜ ਦੇ ਗੀਤ ਬਹੁਤ ਹੀ ਮਾੜੇ ਢੰਗ ਨਾਲ ਗਾਏ ਜਾਂਦੇ ਨੇ ਪੁਰਾਣੇ ਗੀਤ ਵਧੀਆ ਸੀ ਸਾਫ ਸੁਥਰੇ ਢੰਗ ਨਾਲ ਗਾਏ ਜਾਂਦੇ ਸੀ ਅਤੇ ਵਧੀਆ ਵੀ ਲੱਗਦੇ ਸੀ